ਹਾਂਜੀ ਜੇ ਬਚਪਨ ਦੀ ਯਾਤਰਾ ਬਾਰੇ ਗੱਲ ਕਰੀਏ ਤਾਂ ਬਚਪਨ ਬਹੁਤ ਹੀ ਬੈਸਟ ਲੰਘਿਆ ਕਿਉਂਕਿ ਬਚਪਨ ਤਾਂ ਕਦੇ ਵੀ ਵਾਪਸ ਨਹੀਂ ਆ ਸਕਦਾ ਤਾਂ ਮੈਂ ਬਚਪਨ ਦੇ ਵਿੱਚ ਬਹੁਤ ਬਹੁਤ ਜਗ੍ਹਾ 'ਤੇ ਗਈ ਹੋਈ ਹਾਂ ਯਾਤਰਾ ਕੀਤੀ ਹੋਈ ਆ ਤਾਂ ਇੰਨੀਆਂ ਜਗ੍ਹਾ 'ਤੇ ਮੈਂ ਘੁੰਮੀ ਫਿਰੀ ਹੈਗੀ ਹਾਂ ਕਿਉਂਕਿ ਕੁਛ ਕੁ ਤਾਂ ਹੁਣ ਯਾਦ ਵੀ ਨਹੀਂ ਹੈਗੀਆਂ ਪਰ ਜੋ ਯਾਦ ਹੈ ਤਾਂ ਮੈਂ ਬਠਿੰਡਾ ਸ਼ਹਿਰ ਤੋਂ ਬੋਲਦੀ ਪਈ ਹਾਂ ਤਾਂ ਸਾਡੇ ਬਠਿੰਡੇ ਦੇ ਵਿੱਚ ਇੱਕ ਬਾਜਕ ਪਿੰਡ ਹੈ ਜਿੱਥੇ ਕੇ ਉੱਥੇ ਗੁਰੂ ਘਰ ਦੇ ਵਿੱਚ ਜਾਂਦੇ ਸੀਗੇ ਅਸੀਂ ਤਾਂ ਉੱਥੇ ਇੱਕ ਤਲਾਅ ਸੀਗਾ ਉੱਥੇ ਅਸੀਂ ਇਸ਼ਨਾਨ ਵਗੈਰਾ ਕਰਨਾ ਹੈ ਨਾ ਅਤੇ ਜੋ ਕਿ ਮਹੀਨੇ ਤੋਂ ਮੇਲਾ ਭਰਦਾ ਸੀਗਾ ਉੱਥੇ ਜਿਵੇਂ ਮੱਸਿਆ ਦਾ ਮੇਲਾ ਹੋ ਗਿਆ ਹੈ ਨਾ ਤਾਂ ਵਿਸਾਖੀ ਦਾ ਮੇਲਾ ਹੋ ਗਿਆ ਤਾਂ ਅਸੀਂ ਹਰ ਵਾਰ ਜਾਣਾ ਭੂਆ ਜੀ ਹੋਰਾਂ ਨਾਲ ਜਾਣਾ ਤਾਂ ਉਹ ਸਭ ਤੋਂ ਬੈਸਟ ਪਲ ਸੀਗੇ ਜਿਹੜੇ ਕਿ ਜ਼ਿੰਦਗੀ ਦੇ ਯਾਦ ਰਹਿਣਯੋਗ ਸੀਗੇ ਬਚਪਨ 'ਚ ਥਾਂ ਥਾਂ 'ਤੇ ਗਏ ਹਾਂ ਵੈਸੇ ਤਾਂ ਅਤੇ ਪਰ ਸਭ ਤੋਂ ਬੈਸਟ ਜ਼ਿਆਦਾਤਰ ਅਸੀਂ ਮਹੀਨੇ ਤੋਂ ਜਾਂਦੇ ਹੁੰਦੇ ਸੀਗੇ ਮਹੀਨੇ ਤੋਂ ਮੇਲਾ ਭਰਦਾ ਸੀਗਾ ਮੱਸਿਆਂ ਦਾ ਪਰ ਜਾਂ ਵਿਸਾਖੀ ਦਾ ਤਾਂ ਉੱਥੇ ਵੀ ਅਸੀਂ ਮੇਲੇ 'ਚ ਘੁੰਮਣਾ ਫਿਰਨਾ ਵਧੀਆ ਲੱਗਦਾ ਸੀਗਾ ਘੁੰਮਣਾ ਫਿਰਨਾ ਤਾਂ ਅਸੀਂ ਸਾਰਾ ਦਿਨ ਜਿਹੜਾ ਕੇ ਲਾ ਕੇ ਆਉਂਦੇ ਅਸੀਂ ਸਾਰਿਆਂ ਨੇ ਇੱਕਠੇ ਹੋ ਕੇ ਜਾਣਾ ਜਿੱਦਾਂ ਕੇ ਟਰੈਕਟਰ ਟਰਾਲੀ ਜਾਂਦੇ ਹੁੰਦੇ ਸੀ ਉਸ ਟਾਈਮ ਦੇ ਵਿੱਚ ਤਾਂ ਅਸੀਂ ਟਰੈਕਟਰ ਟਰਾਲੀ ਦੇ ਉੱਪਰ ਜਾਂਦੇ ਹੁੰਦੇ ਸੀਗੇ ਮੇਲਾ ਵੇਖਣ ਦੇ ਲਈ ਤਾਂ ਸਭ ਯਾਦ ਰਹਿੰਦਾ ਉਹ ਅਜੇ ਤੱਕ ਨਹਿ ਭੁੱਲਦੇ ਹੈਗੇ